ਗਲੇ ਨੂੰ ਠੀਕ ਕਰਨ ਲਈ ਸਾਡੇ ਪਿੰਡਾਂ ਵਿੱਚ ਬਹੁਤ ਸਾਰੇ ਘਰੇਲੂ ਨੁਕਤੇ ਵਰਤੇ ਜਾਂਦੇ ਆ ਜਿਨ੍ਹਾਂ 'ਚੋਂ ਪਹਿਲਾ ਇਹ ਆ ਕਿ ਸਭ ਤੋਂ ਪਹਿਲਾਂ ਸਾਡੇ ਘਰ ਦੇ ਸਾਨੂੰ ਦੱਸਦੇ ਆ ਤੁਸੀਂ ਗਰਾਰੇ ਕਰੋ ਜਿਹਦੇ ਨਾਲ ਸਾਡਾ ਗਲਾ ਬਿਲਕੁਲ ਠੀਕ ਹੋਜੂਗਾ ਸੈਕਿੰਡ ਆਹ ਕਿਹਾ ਜਾਂਦਾ ਵੀ ਸਾਨੂੰ ਹੈ ਨਾ ਗਰਮ ਪਾਣੀ ਪੀਣਾ ਚਾਹੀਦਾ ਹੈ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਠੰਡੀਆਂ ਚੀਜ਼ਾਂ ਖਾਣ ਦੇ ਨਾਲ ਗਲਾ ਜਲਦੀ ਖਰਾਬ ਹੋ ਜਾਂਦਾ ਸਭ ਤੋਂ ਮਸ਼ਹੂਰ ਇਹ ਚੀਜ਼ ਹੈ ਵੀ ਸਾਡੀਆਂ ਮੰਮੀਆਂ ਸਾਨੂੰ ਆਮ ਤੌਰ 'ਤੇ ਕਾੜ੍ਹਾ ਬਣਾ ਕੇ ਦਿੰਦੀਆਂ ਇਹਨਾਂ ਦੇਸੀ ਨੁਕਤਿਆਂ ਨੂੰ ਵਰਤਣ ਦਾ ਇਹ ਹੀ ਫਾਇਦਾ ਹੁੰਦਾ ਹੈ ਵੀ ਸਾਡੇ ਇਹਦੇ ਨਾਲ ਸਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਰੀਰ 'ਚ ਕੋਈ ਵੀ ਹਾਨੀ ਨਹੀਂ ਪਹੁੰਚਦੀ ਹੈਗੀ ਅਤੇ ਇਹਦੇ ਨਾਲ ਸਾਡਾ ਸਰੀਰ ਜਲਦੀ ਤੋਂ ਜਲਦੀ ਤੰਦਰੁਸਤ ਹੋ ਜਾਂਦਾ ਹੈ